ਭਾਰਤ ਇੱਕ ਬਹੁਤ ਮਹਾਨ ਦੇਸ਼ ਹੈ ਇੱਥੇ ਬਹੁਤ ਤਰ੍ਹਾਂ ਦੀਆਂ ਸੱਭਿਅਤਾਵਾਂ ਕਲਚਰ ਅਤੇ ਲੋਕ ਵੱਸ ਰਹੇ ਨੇ ਇਸੇ ਤਰ੍ਹਾਂ ਇੱਥੇ ਬਹੁਤ ਲੋਕ ਗੀਤ ਹਰੇਕ ਖਿੱਤੇ ਦੇ ਆਪਣੇ ਲੋਕ ਗੀਤ ਅਤੇ ਨਾਚ ਨੇ ਇੱਥੇ ਘੱਟ ਤੋਂ ਘੱਟ ਕਈ ਸੌ ਨਾਚ ਹੋਣਗੇ ਹਰੇਕ ਰਾਜ ਅਤੇ ਸ਼ਹਿਰ ਦੇ ਹਿਸਾਬ ਨਾਲ ਅਤੇ ਮੈਂ ਪੰਜਾਬ ਦਾ ਵਸਨੀਕ ਹੋਣ ਦੇ ਨਾਲ ਨਾਲ ਪੰਜਾਬ ਦਾ ਇੱਕ ਲੋਕ ਨਾਚ ਜਿਹਨੂੰ ਕਹਿੰਦੇ ਨੇ ਭੰਗੜਾ ਇਹਦੀ ਇੰਨੀ ਕੁ ਮਹਾਨਤਾ ਵੀ ਜੇ ਕਹਿੰਦੇ ਨੇ ਭੰਗੜੇ ਦਾ ਢੋਲ ਇੱਕ ਵਾਰੀ ਮੜੀਆਂ 'ਚ ਵਜਾਦੀਏ ਤਾਂ ਉੱਥੇ ਵੀ ਮੁਰਦੇ ਜਾਗ ਪੈਣ ਇੰਨੀ ਅਸੀਂ ਮਹਾਨਤਾ ਦੱਸੀ ਜਾਂਦੀ ਅਤੇ ਪੰਜਾਬ ਦੇ ਇੱਕ ਮਸ਼ਹੂਰ ਲੋਕ ਗਾਇਕ ਅਤੇ ਲੋਕ ਨਾਚ ਨੱਚਣ ਵਾਲੇ ਪੰਮੀ ਬਾਈ ਜਿਹਨਾਂ ਨੂੰ ਅਸੀਂ ਅਕਸਰ ਟੀ ਵੀ ਯੂਟੀਊਬ ਚੈਨਲ 'ਤੇ ਲਾਈਵ ਵੀ ਕਈ ਵਾਰ ਯੂਨੀਵਰਸਿਟੀ ਦੇ ਵਿੱਚ ਦੇਖਿਆ ਹੈ ਉਹ ਬਹੁਤ ਹੀ ਮਸ਼ਹੂਰ ਹਨ ਉਹਨਾਂ ਨੂੰ ਵਿਸ਼ਵ ਦੇ ਵਿੱਚ ਪ੍ਰਸਿੱਧੀ ਹੈ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਬਹੁਤ ਨਾਮਵਰ ਚੁਣਿੰਦਾ ਅਵਾਰਡ ਮਿਲ ਚੁੱਕੇ ਹਨ ਉਹ ਲੋਕ ਨਾਚ ਪੰਜਾਬ ਦਾ ਭੰਗੜਾ ਪਾਉਂਦੇ ਹਨ ਅਤੇ ਨਾਲ ਭੰਗੜੇ ਦੀ ਟੀਮਾਂ ਦੇ ਬੋਲੀਆਂ ਵੀ ਪਾਉਂਦੇ ਹਨ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਜੱਜ ਦੇ ਤੌਰ 'ਤੇ ਵੀ ਨਿਵਾਜਿਆ ਜਾਂਦਾ ਹੈ ਉਹ ਲੋਕ ਨਾਚਾਂ ਦੀ ਜਜਿੰਗ ਕਰਦੇ ਹਨ ਅਤੇ ਮੈਂ ਇੱਕ ਲੋਕ ਨਾਚ ਨੂੰ ਆਪਣਾ ਪੰਜਾਬ ਦੇ ਖਿੱਤੇ ਹੋਣ ਦੇ ਕਾਰਨ ਭੰਗੜੇ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਭੰਗੜੇ ਦੇ ਨਾਲ ਮੈਂ ਪਿਛਲੇ ਦੋ ਸਾਲ ਤੋਂ ਪਹਿਲਾਂ ਖਾਲਸਾ ਕਾਲਜ ਦੇ ਵਿੱਚ ਬੋਲੀਆਂ ਵੀ ਪਾਈਆਂ ਹਨ ਅਤੇ ਇੱਕ ਵਾਰੀ ਛੱਬੀ ਜਨਵਰੀ ਦੋ ਹਜ਼ਾਰ ਵੀਹ ਨੂੰ ਪੋਲੋ ਗਰੋਨ ਪਟਿਆਲਾ ਵਿੱਚ ਭੰਗੜਾ ਲਾਈਵ ਦੇ ਨਾਲ ਵੀ ਬੋਲੀਆਂ ਪਾਈਆਂ ਸਨ ਅਤੇ ਇਹ ਮੇਰੇ ਦਿਲ ਜਾਨ ਵਿੱਚ ਵੱਸਦਾ ਹੈ